ਮੈਂ ਆਪਣੇ ਜੀਵਨ ਵਿੱਚ ਕਿਸੇ ਵੀ ਸ਼ੁਭ ਘਟਨਾ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਜਾ ਕੇ ਹੀ ਕਰਦੀ ਹਾਂ ਜਦ ਵੀ ਮੇਰਾ ਕੋਈ ਵੀ ਪੇਪਰ ਹੁੰਦਾ ਹੈ ਮੈਂ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦੀ ਹਾਂ ਅਤੇ ਮੇਰੇ ਮੰਮਾ ਮੈਨੂੰ ਹਮੇਸ਼ਾ ਦਹੀਂ ਸ਼ੱਕਰ ਦਿੰਦੇ ਹਨ ਤਾਂ ਜੋ ਮੈਂ ਜਿਸ ਕੰਮ ਦੇ ਲਈ ਵੀ ਜਾ ਰਹੀ ਹਾਂ ਅਗਰ ਪੇਪਰ ਦੇਣ ਜਾ ਰਹੀ ਹਾਂ ਕਿ ਜੋ ਮੇਰਾ ਪੇਪਰ ਹੈ ਬਹੁਤ ਜ਼ਿਆਦਾ ਵਧੀਆ ਹੋ ਸਕੇ ਕਈ ਵਾਰ ਜਦ ਮੈਂ ਕਿਸੇ ਜਗ੍ਹਾ 'ਤੇ ਜਾਣਾ ਹੁੰਦਾ ਏ ਤਾਂ ਅਕਸਰ ਮੇਰੇ ਮੰਮਾ ਮੈਨੂੰ ਗੁੜ ਦੀ ਰੋੜੀ ਦਿੰਦੇ ਹਨ ਤਾਂ ਜੋ ਮੇਰਾ ਕੰਮ ਆ ਉਹ ਬਿਨਾਂ ਕਿਸੇ ਰੁਕਾਵਟ ਤੋਂ ਬਿਨਾਂ ਕਿਸੇ ਮੁਸ਼ਕਿਲ ਤੋਂ ਮੈਂ ਓਸ ਨੂੰ ਪੂਰਾ ਕਰ ਸਕਾਂ ਮੈਂ ਆਪਣੇ ਹਰ ਕੰਮ ਦੀ ਹੁਣ ਤੱਕ ਹਰ ਕੰਮ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਜਾ ਕੇ ਕੀਤੀ ਹੈ ਪਰਮਾਤਮਾ ਦਾ ਆਸ਼ੀਰਵਾਦ ਹਮੇਸ਼ਾ ਲਿਆ ਏ ਤਾਂ ਜੋ ਮੇਰਾ ਕੰਮ ਹੈ ਜਿਸ ਕੰਮ ਦੇ ਲਈ ਮੈਂ ਜਾ ਰਹੀ ਹਾਂ ਓਸ ਨੂੰ ਮੈਂ ਬਹੁਤ ਜ਼ਿਆਦਾ ਵਧੀਆ ਆਪਣਾ ਹੰਡਰਡ ਪਰਸੈਂਟ ਦੇ ਕੇ ਓਸ ਨੂੰ ਖਤਮ ਕਰ ਸਕਾਂ